ਹਾਂਜੀ ਮੈਂ ਸਿਲਾਈ ਕਢਾਈ ਬਾਰੇ ਜਾਣਦੀ ਹਾਂ ਮੈਂ ਖੁਦ ਕੱਪੜੇ ਸਿਉਂਦੀ ਹਾਂ ਮੈਂ ਬੱਚਿਆਂ ਦੇ ਵੀ ਕੱਪੜੇ ਸੀਅ ਲੈਂਦੀ ਹਾਂ ਜਿੱਦਾਂ ਕੁੜਤੇ ਪਜਾਮੇ ਕਢਾਈ ਵਾਲੇ ਸੂਟ ਜੇ ਪੈਪਿੰਗ ਪੈਪਿੰਗ ਵਾਲੇ ਵੀ ਸੂਟ ਸੀ ਲੈਂਦੀ ਹਾਂ ਲਾ ਲਾਈਨਿੰਗ ਵਾਲੇ ਵੀ ਕੱਪੜੇ ਸੀਅ ਲੈਂਦੀ ਹਾਂ ਜਿੱਦਾਂ ਮਤਲਬ ਬੁਣਨਾ ਵੀ ਬਹੁਤ ਪਸੰਦ ਆ ਮੈਨੂੰ ਸਲਵਾਰ ਸੂਟ ਪੰਜਾਬੀ ਸੂਟ ਸਿਉਣੇ ਬਹੁਤ ਪਸੰਦ ਹਨ ਮੈਨੂੰ ਅਤੇ ਕੋਈ ਕੋਈ ਸਾਡੇ ਘਰ 'ਚ ਕੋਈ ਵੀ ਨਹੀਂ ਕੱਪੜੇ ਸਿਉਂਦੇ ਮੈਂ ਖੁਦ ਸਿਉਂਦੀ ਹਾਂ ਮੈਨੂੰ ਆਪਣੇ ਕੱਪੜੇ ਖੁਦ ਸਿਉਂਣੇ ਬਹੁਤ ਪਸੰਦ ਹਨ ਸਾਡੇ ਪਿੰਡ ਵਿੱਚ ਮਰਦ ਵੀ ਬਹੁਤ ਕੱਪੜੇ ਸਿਉਂਦੇ ਹਨ ਸਿਲਾਈ ਕਰਦੇ ਹਨ ਧੰਨਵਾਦ